ਮੇਰੀ ਰਸੋਈ ਵਿੱਚ ਜਿਹੜੇ ਬਿਜਲੀ ਦੇ ਉਪਕਰਨ ਹੈ ਉਹ ਹੈਗੇ ਆ ਪੱਖਾ ਠੀਕ ਹੈ ਉਸ ਤੋਂ ਬਾਅਦ ਐਕਜੋਸ਼ਟ ਫ਼ੈਨ ਆ ਜਿਹੜਾ ਕਿ ਧੁੰਆਂ ਬਾਹਰ ਕੱਢਣ ਲਈ ਹੁੰਦਾ ਏ ਸਾਨੂੰ ਹੀ ਪਤਾ ਹੀ ਹੈ ਠੀਕ ਹੈ ਜੀ ਲਾਈਟਸ ਹੈਗੀਆਂ ਏ ਇਹ ਸਾਰਾ ਕੁਛ ਮੇਰੀ ਰਸੋਈ ਵਿੱਚ ਹੈ ਉਸ ਤੋਂ ਬਾਅਦ ਕੀ ਹੈ ਕਿ ਜਿੱਦਾਂ ਮਿਕਸਰ ਹੈ ਹੈ ਨਾ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਕੁੰਡੀ ਸੋਟਾ ਚੱਕਣਾ ਪੈਂਦਾ ਸੀਗਾ ਉਹਨੂੰ ਪਹਿਲੇ ਇੰਨੇ ਭਾਰੀ ਨੂੰ ਚੱਕੋ ਫਿਰ ਧੋਵੋ ਸਾਫ਼ ਕਰੋ ਫਿਰ ਉਹਦੇ 'ਚ ਚੀਜ਼ਾਂ ਕੁੱਟੋ ਕੱਢੋ ਉਸ ਤੋਂ ਬਾਅਦ ਫਿਰ ਧੋਵੋ ਹੈ ਨਾ ਉਹਨੂੰ ਇੰਨੇ ਭਾਰੀ ਨੂੰ ਚੱਕ ਕੇ ਇਹ ਚੀਜ਼ ਤੋਂ ਹੁਣ ਕੀ ਹੈ ਕਿ ਸਾਨੂੰ ਕਾਫ਼ੀ ਸਹੂਲਤ ਮਿਲ ਗਈ ਕਿ ਸਾਡੇ ਕੋਲ ਮਿਕਸਰ ਹੈ ਉਸ ਤੋਂ ਬਾਅਦ ਗੈਸ ਸਿਲੰਡਰ ਕੀ ਹੈ ਜਿਹੜਾ ਚੁੱਲ੍ਹਾ ਹੈ ਚੁੱਲ੍ਹੇ ਪਰ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਸੀ ਹੈ ਨਾ ਪਹਿਲੇ ਜ਼ਮਾਨੇ 'ਚ ਕੀ ਪਹਿਲੇ ਤੁਸੀਂ ਬਾਹਰੋਂ ਲੱਕੜੀਆਂ ਲੈ ਕੇ ਆਉ ਠੀਕ ਹੈ ਲੱਕੜੀਆਂ ਗਿੱਲੀਆਂ ਏ ਸੁੱਕੀਆਂ ਏ ਉਹ ਅੱਗ ਬਾਲਦੀਆਂ ਕਿਵੇਂ ਹੈ ਨਾ ਫਿਰ ਕੀ ਹੈ ਕਿ ਜਿਹੜਾ ਉਹ ਬੋਹਟਾ ਜਿਹਨੂੰ ਆਪਾਂ ਉਹ ਜਿਹੜਾ ਗੋਬਰ ਦਾ ਬਣਦਾ ਏ ਠੀਕ ਹੈ ਉਹ ਵਿੱਚ ਲਗਾਉ ਮਿੱਟੀ ਦਾ ਤੇਲ ਚਾਹੀਦਾ ਏ ਸਾਰੀਆਂ ਚੀਜ਼ਾਂ ਚਾਹੀਦੀਆਂ ਹੈ ਨਾ ਕਿ ਤਾਂ ਕੀ ਹੈ ਕਿ ਆਪਾਂ ਉਹ ਚੀਜ਼ ਨੂੰ ਬਾਲ ਸਕਦੇ ਸੀਗੇ ਠੀਕ ਹੈ ਨਾ ਅਤੇ ਹੁਣ ਉਹ ਚੀਜ਼ ਤੋਂ ਸਾਨੂੰ ਕੀ ਹੈ ਪੂਰੀ ਤਰ੍ਹਾਂ ਸਾਨੂੰ ਛੂਟ ਮਿਲਗੀ ਕਿ ਗੈਸ ਸਿਲੰਡਰ ਹੈ ਆਪਣਾ ਸਿਲੰਡਰ ਭਰਾਓ ਲਾਇਟਰ ਲਗਾਓ ਅੱਗ ਬਾਲੋ ਅਤੇ ਆਪਣਾ ਜਿਹੜਾ ਕੰਮ ਹੈ ਉਹ ਕਰ ਲਉ ਠੀਕ ਹੈ ਫਿਰ ਜਿਹੜਾ ਇੱਕ ਓਵਨ ਹੈ ਓਵਨ ਦੀ ਸਾਨੂੰ ਅੱਜ ਦੇ ਸਮੇਂ ਵਿੱਚ ਬੜੀ ਸਹੂਲਤ ਹੋ ਗਈ ਜਿਵੇਂ ਕਿ ਅੱਜ ਕੱਲ੍ਹ ਜ਼ਿਆਦਾਤਰ ਵਰਕਿੰਗ ਹੀ ਹੈ ਅੱਗੇ ਤਾਂ ਅੋਰਤਾਂ ਘਰ 'ਚ ਹੁੰਦੀਆਂ ਸੀਗੀਆ ਠੀਕ ਹੈ ਨਾ ਜੇ ਚੁੱਲ੍ਹਾ ਵੀ ਉਹਨਾਂ ਨੇ ਬਾਲਣਾ ਚਲੋ ਘਰ ਵਿੱਚ ਆ ਜਾਂ ਗੈਸ ਕੁਛ ਵੀ ਹੈ ਪਰ ਕੀ ਹੈ ਕਿ ਜਿਹੜੇ ਬੱਚੇ ਆ ਅਸੀਂ ਉਹਨਾਂ ਨੂੰ ਉਹ ਵਾਰ ਵਾਰ ਗੈਸ ਨਾਲ ਜਿਹੜੇ ਛੋਟੇ ਬੱਚੇ ਹੁੰਦੇ ਹੈ ਅਸੀਂ ਨਹੀਂ ਉਹਨਾਂ ਨੂੰ ਹੈ ਨਾ ਕਿ ਗੈਸ ਜੋ ਕਰੋ ਕਿਉਂਕਿ ਇਹ ਵੀ ਇੱਕ ਮਤਲਬ ਡੇਨਜਰ ਹੋ ਸਕਦਾ ਏ ਨੀਚੋਂ ਔਨ ਔਫ ਬੱਚੇ ਤੋਂ ਰਹਿ ਜਾਵੇ ਕੁਛ ਹੋ ਜਾਵੇ ਹੈ ਨਾ ਅਤੇ ਕੀ ਹੈ ਓਵਨ ਨੇ ਸਾਨੂੰ ਬੜੀ ਵੱਡੀ ਸਹੂਲਤ ਦੇ ਤੀ ਕੀ ਹੈ ਪਲੱਗ ਲੱਗਿਆ ਹੁੰਦਾ ਏ ਜੀ ਔਨ ਕਰੋ ਸਵਿੱਚ ਵਿੱਚ ਆਪਣਾ ਜੋ ਵੀ ਗਰਮ ਕਰਨਾ ਹੈ ਰੱਖੋ ਅਤੇ ਉਸ ਤੋਂ ਬਾਅਦ ਟਾਇਮ ਦਿੱਤਾ ਹੁੰਦਾ ਏ ਉਹਦੇ ਵਿੱਚ ਵਿੱਚ ਉਹ ਚੀਜ਼ ਗਰਮ ਹੋ ਜਾਂਦੀ ਆ ਅਤੇ ਜਿਹੜੀਆਂ ਇਹ ਚੀਜ਼ਾਂ ਏ ਇਹਨਾਂ ਨੇ ਸਾਡੀ ਜਿਹੜੀ ਅੱਜ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਬਹੁਤ ਜ਼ਿਆਦਾ ਸੌਖਾਲੀ ਕਰਤਾ